ਜਦੋਂ ਅਸੀਂ ਰਸੋਈ ਵਿੱਚ ਕੋਈ ਵੀ ਭੋਜਨ ਤਿਆਰ ਕਰਦੇ ਹਾਂ ਤਾਂ ਸਾਨੂੰ ਕਈ ਵਾਰ ਕਈ ਚੀਜ਼ਾਂ ਮਿਲਦੀਆਂ ਹੀ ਨਹੀਂ ਹਨ ਭਾਵੇਂ ਕੋਈ ਮਿੱਠੇ ਵਿੱਚ ਹੋਵੇ ਜਾਂ ਫਿਰ ਨਮਕੀਨ ਵਿੱਚ ਹੋਵੇ ਅਸੀਂ ਫੋਨ ਉੱਤੇ ਜਾਂ ਟੀ ਵੀ ਉੱਤੇ ਕੋਈ ਵੀ ਰੈਸਪੀ ਦੇਖਦੇ ਹਾਂ ਅਤੇ ਸਾਡੇ ਕੋਲ ਸਮਾਨ ਪੂਰਾ ਨਹੀਂ ਹੁੰਦਾ ਜੇਕਰ ਆਪਣਾ ਮਿੱਠੇ ਦੀ ਮਿੱਠੇ ਦੀ ਗੱਲ ਕਰੀਏ ਤਾਂ ਕੇਸਰ ਰੈਸਬਰੀ ਪਿਸਤਾ ਚਰੌਂਜੀ ਖੋਆ ਅਰਾ ਰੋਟ ਨਹੀਂ ਮਿਲਦਾ ਜਿਸ ਕਾਰਨ ਸਾਡੀ ਰੈਸਪੀ ਤਿਆਰ ਨਹੀਂ ਹੁੰਦੀ ਜੇਕਰ ਅਸੀਂ ਨਮਕੀਨ ਭੋਜਨ ਦੀ ਗੱਲ ਕਰੀਏ ਤਾਂ ਸਾਨੂੰ ਲਾਲ ਅਤੇ ਪੀਲੀ ਸ਼ਿਮਲਾ ਮਿਰਚ ਨਹੀਂ ਮਿਲਦੀ ਫੂਡ ਕਲਰ ਜੋ ਕਿ ਮਠਿਆਈਆਂ ਵਿੱਚ ਪੈਂਦਾ ਹੈ ਉਹ ਵੀ ਆਮ ਦੁਕਾਨਾਂ ਤੋਂ ਨਹੀਂ ਮਿਲਦਾ ਇਸ ਕਾਰਨ ਅਸੀਂ ਕੋਈ ਵੀ ਰੈਸਪੀ ਤਿਆਰ ਨਹੀਂ ਕਰ ਸਕਦੇ ਅੱਜ ਕੱਲ੍ਹ ਸ਼ਹਿਰ ਵਿੱਚ ਬਹੁਤ ਸਾਰੀਆਂ ਚੀਜ਼ਾਂ ਖਾਣ ਵਾਲੀਆਂ ਆਉਂਦੀਆਂ ਹਨ ਜੋ ਕਿ ਸਾਡੇ ਪਿੰਡਾਂ ਵਿੱਚ ਨਹੀਂ ਮਿਲਦੀਆਂ ਜਿਵੇਂ ਪੀਜ਼ਾ ਬਣਾਉਣਾ ਹੋਵੇ ਤਾਂ ਸਾਨੂੰ ਚੀਜ਼ ਹੀ ਨਹੀਂ ਮਿਲਦੀ